ਹੈਲੋ ਹਾ ਸਤਿ ਸ਼੍ਰੀ ਅਕਾਲ ਜੀ

ਜੀ ਜ ਹਾਂਜੀ ਹਾਂਜੀ ਹਾਂਜੀ ਆ ਜਾਓ ਕੋਈ ਨਹੀਂ ਜੀ ਆਪਣੇ ਕੋਲ ਬੱਸਾਂ ਵਧੀਆ ਮੰਨ ਲਓ ਜੀ ਏ ਸੀ ਗੱਡੀਆਂ ਸਾਰੀਆਂ ਹਾਂਜੀ ਹਾਂਜੀ ਮਤਲਬ ਬਹੁਤ ਵਧੀਆ ਜੀ ਸਾਰਿਆਂ ਨਾਲ ਪੂਰੀ ਸਹੂਲਤ ਆ ਡਰਾਈਵਰ ਵਧੀਆ ਜੀ ਏ ਸੀ ਬੱਸਾਂ ਜਿੱਥੇ ਮਰਜ਼ੀ ਤੱਕ ਘੁੰਮ ਕੇ ਆਇਓ ਕੋਈ ਚੱਕਰ ਨਹੀਂ ਵਧੀਆ ਬੱਸਾਂ ਸਰਕਾਰ ਵੱਲੋਂ ਵੀ ਵਧੀਆ ਪ੍ਰਾਈਵੇਟ ਸਰਵਿਸ ਵੀ ਹੈ ਜੀ ਸਰਕਾਰੀ ਵੀ ਹੈ ਜੀ ਜੋ ਸਾਰੀ ਹੈ ਜੀ ਆਪਣੇ ਕੋਲ ਬਹੁਤ ਵਧੀਆ ਬੱਸਾਂ ਜੀ ਜਿੰਨੀਆਂ ਮਰਜ਼ੀ ਜਦੋਂ ਮਰਜ਼ੀ ਡਰਾਈਵਰ ਨੇ ਜੀ ਆਪਣੇ ਨਾ ਨਾ ਕੋਈ ਦਿੱਕਤ ਨਹੀਂ ਆਉਣੀ ਜੀ ਵਿੱਚ ਸਹੂਲਤਾਂ ਸਾਰੀਆਂ ਗੱਡੀ ਦੇ ਵਿੱਚ ਠੀਕ ਹੈ ਜੀ ਹਾਂ ਹਾਂ ਟਾਈਮ ਤੋਂ ਟਾਈਮ ਕੋਈ ਚੱਕਰ ਹੀ ਕੋਈ ਨਹੀਂ ਜੀ ਜਮਾਂ ਸਹੀ ਟਾਈਮ ਤੋਂ ਟਾਈਮ ਜਾਣਗੀਆਂ ਸਹੀ ਟਾਈਮ 'ਤੇ ਆਉਣਗੀਆਂ ਨਾ ਨਾ ਨਾ ਲੇਟ ਕਿਹੜੀ ਘੰਟੇ ਘੰਟੇ ਨਹੀਂ ਪੰਜ ਪੰਜ ਮਿੰਟਾਂ ਬਾਅਦ ਸਰਵਿਸ ਹੈ ਜੀ ਹੋਰ ਸੁਣਾਓ ਬਹੁਤ ਵਧੀਆ ਵਧੀਆ ਇਕ ਨੰਬਰ ਪੇਜ 'ਤੇ ਕਰੋ ਜਿਹੜੀ ਤੁਸੀਂ ਨਹੀਂ ਕਰਨਾ ਗੱਡੀਆਂ ਬਾਰੇ ਤਾਂ ਜਮਾਂ ਇੱਕ ਨੰਬਰ ਹੈ ਜੀ ਗੱਡੀ ਚੱਕਰ ਹੀ ਕੋਈ ਨਹੀਂ ਜੀ ਜਦੋਂ ਮਰਜ਼ੀ ਕਹੋਗੇ ਤੁਸੀਂ ਉਦੋਂ ਹੀ ਤੁਹਾਨੂੰ ਜਿੱਥੇ ਵੀ ਤੁਸੀਂ ਉਤਰਨਾ ਹੋਇਆ ਘੁੰਮਣ ਖਾਤਰ ਉੱਥੇ ਹੀ ਤੁਹਾਨੂੰ ਡਰਾਈਵਰ ਰੋਕਣਗੇ ਜੀ ਠੀਕ ਹੈ ਜੀ ਕੋਈ ਚੱਕਰ ਨੀਗਾ ਜਿੱਥੇ ਮਰਜ਼ੀ ਤੁਸੀਂ ਕਹੋਗੇ ਜੀ ਆਹ ਜਗ੍ਹਾ ਤੁਹਾਨੂੰ ਵਧੀਆ ਲੱਗਦੀ ਹੈ ਚੰਡੀਗੜ੍ਹ ਹਾਂਜੀ ਹਾਂ ਨਾ ਨਾ ਕੋਈ ਨਹੀਂ ਜਦੋਂ ਅਸੀਂ ਅਸੂਲ ਆ ਤੁਹਾਡੇ ਨਾਲ ਹੈ ਜਦੋਂ ਮਰਜ਼ੀ ਕਹਿ ਦਿਓ ਸਾਨੂੰ ਠੀਕ ਆ ਦੱਸ ਦਿਓ ਜਦੋਂ ਮਰਜ਼ੀ ਆਓ ਜੀ ਭਾਅ ਜੀ ਜੀ ਆਇਆ ਨੂੰ ਤੁਹਾਨੂੰ ਜੀ ਠੀਕ ਆ ਆਇਓ ਜ਼ਰੂਰ ਘੁੰਮਾ ਕੇ ਲਿਆਵਾਂਗੇ ਗੱਡੀਆਂ ਸਾਡੀਆਂ ਬਹੁਤ ਵਧੀਆ ਜੀ ਠੀਕ ਆ ਸਾਰੀ ਚੀਜ਼ ਠੀਕ ਆ ਜੀ ਓਕੇ ਜੀ ਸਰ ਓਕੇ ਓਕੇ ਸਰ